ਅੱਜ ਦੇ ਯੁੱਗ ਦੇ ਵਿੱਚ ਬਿਜਲੀ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਚੱਲ ਸਕਦਾ ਘਰ ਵਿੱਚ ਕੋਈ ਵੀ ਕੰਮ ਹੈ ਉਹਨੇ ਬਿਜਲੀ ਤੋਂ ਬਿਨਾਂ ਨਹੀਂ ਹੋਣਾ ਅਤੇ ਜੇ ਆਪਾਂ ਕਿਸੇ ਆਫਿਸ 'ਚ ਬੈਠੇ ਹਾਂ ਤਾਂ ਉੱਥੇ ਵੀ ਬਿਜਲੀ ਨੇ ਬਿਜਲੀ ਨਾਲ ਹੀ ਸਾਰੇ ਕੰਮ ਹੋਣੇ ਹਨ ਅੱਜ ਕੱਲ੍ਹ ਕੰਪਿਊਟਰ ਜਾਂ ਹੋਰ ਪੱਖੇ ਬਿਜਲੀ ਸਭ ਪੱਖੇ ਅਤੇ ਹੋਰ ਟਿਊਬਾਂ ਲਾਈਟਾਂ ਸਭ ਬਿਜਲੀ ਨਾਲ ਹੀ ਚੱਲਦੀਆਂ ਹਨ ਉਹਨਾਂ ਤੋਂ ਬਿਨਾਂ ਰੋਸ਼ਨੀ ਦਾ ਹੋਰ ਕੋਈ ਵਿਕਲਪ ਵੀ ਨਹੀਂ ਹੈ ਬਾਕੀ ਇਨਵਰਟਰ ਘਰਾਂ ਦੇ ਵਿੱਚ ਤਾਂ ਸਭ ਕੋਲ ਹੀ ਹੁੰਦੇ ਹਨ ਅਤੇ ਇਸ ਤੋਂ ਇਲਾਵਾ ਆਫਿਸ ਦੇ ਵਿੱਚ ਜਨਰੇਟਰ ਵਗੈਰਾ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕਿ ਬਿਜਲੀ ਦੇ ਕੱਟ ਦੇ ਦੌਰਾਨ ਕੋਈ ਵੀ ਕੰਮ ਪ੍ਰਭਾਵਤ ਨਾ ਹੋਵੇ ਇਸ ਤੋਂ ਇਲਾਵਾ ਅੱਜ ਕੱਲ੍ਹ ਸੋਲਰ ਸਿਸਟਮ ਚੱਲ ਗਿਆ ਜੀ ਸੋਲਰ ਸਿਸਟਮ ਨਾਲ ਬਿਜਲੀ ਦਾ ਵਿਕਲਪ ਲੱਭਿਆ ਗਿਆ ਹੈ ਪਰ ਇਸਨੂੰ ਥੋੜ੍ਹਾ ਮਹਿੰਗਾ ਹੋਣ ਕਰਕੇ ਲੋਕ ਘੱਟ ਲਗਵਾ ਰਹੇ ਹਨ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਸਸਤਾ ਹੋ ਜਾਵੇਗਾ ਅਤੇ ਫਿਰ ਬਿਜਲੀ ਦੇ ਹੋਰ ਵੀ ਵਿਕਲਪ ਸ਼ਾਇਦ ਆ ਜਾਣ ਅਤੇ ਇਸ ਨਾਲ ਹਰ ਕੰਮ ਆਸਾਨ ਹੋ ਜਾਵੇਗਾ